ਵਿਗਿਆਨ ਅਤੇ ਤੈਕਨੋਲੋਜੀ ਬਾਰੇ ਅਸੀਂ ਗੱਲ ਕਰੀਏ ਤਾਂ ਇਹ ਬਹੁਤ ਹੀ ਆਕਰਸ਼ਕ ਤਰੀਕੇ ਨਾਲ਼ ਸਾਡੀਆਂ ਜ਼ਰੂਰਤਾਵਾਂ ਨੂੰ ਬਹੁਤ ਹੀ ਨਵੀ ਨਵੀਨਤਾ ਲਿਆ ਰਿਹਾ ਹੈ ਅਤੇ ਉਹਨਾਂ ਵਿੱਚ ਬਹੁਤ ਹੀ ਵਾਧਾ ਕਰ ਰਿਹਾ ਹੈ ਜੇਕਰ ਅਸੀਂ ਗੱਲ ਕਰੀਏ ਵਿਗਿਆਨ ਦੀ ਤਾਂ ਮੋਬਾਇਲ ਫ਼ੋਨ ਇੱਕ ਬਹੁਤ ਹੀ ਆਧੁਨਿਕ ਚੀਜ਼ ਬਣੀ ਹੈ ਜਿਸ ਨਾਲ਼ ਅਸੀਂ ਹਰ ਕਿਸਮ ਦਾ ਕੰਮ ਇੱਕ ਥਾਂ ਬੈਠੇ ਹੀ ਸਿਰਫ਼ ਆਪਣੇ ਹੱਥ ਵਿੱਚ ਮੋਬਾਇਲ ਲੈ ਕੇ ਹੀ ਕਰ ਸਕਦੇ ਹਾਂ ਸਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸਾਡੇ ਬਹੁਤ ਸਾਰੇ ਕੰਮ ਮੋਬਾਇਲ ਫ਼ੋਨ ਤੋਂ ਹੀ ਹੋ ਜਾਂਦੇ ਹਨ ਅਤੇ ਹੋਰ ਗੱਲ ਕਰੀਏ ਤਾਂ ਇਲੈਕਟ੍ਰਿਕ ਸਕੂਟਰ ਅਤੇ ਹੋਰ ਹੋਰ ਇਲੈਕਟ੍ਰਿਕ ਚੀਜ਼ਾਂ ਜੋ ਕਿ ਨਵੀਆਂ ਨਵੀਆਂ ਆ ਰਹੀਆਂ ਹਨ ਉਹਦੇ ਨਾਲ਼ ਸਾਡਾ ਬਹੁਤ ਹੀ ਵਾਧਾ ਹੋ ਰਿਹਾ ਹੈ ਇਲੈਕਟ੍ਰਿਕ ਕਾਰਾਂ ਅਤੇ ਹੋਰ ਚੀਜ਼ਾਂ ਕਾਰਨ ਪ੍ਰਦੂਸ਼ਣ ਦੇ ਵਿੱਚ ਵੀ ਬਹੁਤ ਕ ਬਹੁਤ ਘੱਟ ਰਿਹਾ ਹੈ ਅਤੇ ਸਾਡੇ ਸਮਾਜ ਵਾਤਾਵਰਣ ਨੂੰ ਵੀ ਬਹੁਤ ਵਾਧਾ ਹੋ ਰਿਹਾ ਹੈ ਜਿਸ ਨਾਲ਼ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਪ੍ਰੇਰਿਤ ਕਰ ਸਕਦੇ ਹਾਂ ਕਿ ਸਾਨੂੰ ਕਦੇ ਵੀ ਸਮਾਜ ਵਿੱਚ ਇਹੋ ਜਿਹੀਆਂ ਜ਼ਹਿਰੀਲੀਆਂ ਗੈਸਾਂ ਨਹੀਂ ਛੱਡਣੀਆਂ ਚਾਹੀਦੀਆਂ ਅਤੇ ਸਮਾਜ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬ ਬਚਾਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ